ਮੈਂ ਅਤੁਲ ਪੰਜਾਬ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪੰਜਾਬ ਦੀ ਧਰਤੀ ਨੂੰ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹਰ ਮੇਲੇ ਅਤੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੋ ਕਿ ਸਾਰਾ ਪਰਿਵਾਰ ਰਲ ਮਿਲ ਕੇ ਮਨਾਉਂਦਾ ਹੈ ਪੰਜਾਬ ਵਿੱਚ ਕਈ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਜਿੱਦਾਂ ਕਿ ਵਿਸਾਖੀ ਨਵਰਾਤਰੇ ਗੁਰਦਾਸਪੁਰ ਅਤੇ ਹੋਰ ਵੀ ਕਈ ਤਿਉਹਾਰ ਜਿੱਦਾਂ ਕਿ ਲੋਹੜੀ ਅਤੇ ਦਿਵਾਲੀ ਹੋਲੀ ਆਦਿ ਪਰ ਪੰਜਾਬ ਵਿੱਚ ਮੇਨ ਵਿਸਾਖੀ ਅਤੇ ਗੁਰਪੁਰਬ ਨੂੰ ਬਹੁਤ ਹੀ ਬਹੁਤ ਹੀ ਪਿਆਰ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਅਤੇ ਪੰਜਾਬ ਦੀ ਧਰਤੀ ਵਿੱਚ ਵਿਸਾਖੀ ਦਾ ਵੀ ਬਹੁਤ ਬਹੁਤ ਮ ਜਿਹੜਾ ਹੁੰਦਾ ਹੈ ਕਿ ਮਜ਼ਬੂਤ ਹਿੱਸਾ ਹੈ ਪੰਜਾਬ ਲੋਕ ਵਿਸਾਖੀ ਵਾਲੇ ਦਿਨ 'ਤੇ ਬਹੁਤ ਹੀ ਖੁਸ਼ ਹੁੰਦੇ ਹਨ ਮੈਂ ਖੁਦ ਬਹੁਤ ਖੁਸ਼ ਹੁੰਦਾ ਹਾਂ ਜਦੋਂ ਵਿਸਾਖੀ ਆਉਂਦੀ ਹੈ ਵਿਸਾਖੀ ਵਾਲੇ ਦਿਨ ਜਿਹੜੇ ਕਿ ਕਣਕ ਪੱਕ ਗਈ ਹੁੰਦੀ ਹੈ ਉਹਨੂੰ ਕਿਸਾਨ ਕੱਟਦੇ ਹੈ ਅਤੇ ਤਿਉਹਾਰ ਮਨਾਉਂਦੇ ਹਨ ਕਿ ਉਹਨਾਂ ਦੀ ਕਣਕ ਬਹੁਤ ਵਧੀਆ ਹੋਈ ਹੈ ਇਸ ਦਿਨ ਸਾਰੇ ਲੋਕ ਨਵੇਂ ਕੱਪੜੇ ਪਾਉਂਦੇ ਹਨ ਅਤੇ ਪੀਲੇ ਰੰਗ ਦੀ ਚੀਜ਼ਾਂ ਬਣਾਉਂਦੇ ਹਨ ਅਸੀਂ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਜਾ ਕੇ ਗੁਰਦੁਆਰੇ ਮੱਥਾ ਟੇਕਦੇ ਹਾਂ ਅਤੇ ਉਸ ਤੋਂ ਬਾਅਦ ਜਾ ਕੇ ਮੇਲੇ ਵਿੱਚ ਕੁਛ ਨਾ ਕੁਛ ਖਾ ਪੀ ਕੇ ਜਾਂ ਫਿਰ ਮੇਲੇ ਵਿੱਚ ਜਾਂਦੇ ਹਾਂ ਤਾਂ ਕਿ ਅਸੀਂ ਕੁਛ ਨਾ ਕੁਛ ਖਰੀਦ ਕੇ ਆਈਏ ਜਾਂ ਫਿਰ ਮੇਲੇ ਵਿੱਚ ਹੋਰ ਵੀ ਕੁਛ ਵੇਖ ਕੇ ਆਈਏ ਉਸ ਤੋਂ ਇਲਾਵਾ ਪੰਜਾਬ ਵਿੱਚ ਗੁਰਪੁਰਬ ਨੂੰ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਲੋਕ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਂਦੇ ਹਨ ਅਤੇ ਮੱਥਾ ਟੇਕਦੇ ਹਨ ਤਾਂ ਕਿ ਉਹ ਪੰਜਾਬੀ ਕਲਚਰ ਨਾਲ ਹੋਰ ਜੁੜ ਸਕਣ ਉਸ ਤੋਂ ਇਲਾਵਾ ਪੰਜਾਬ ਵਿੱਚ ਨਵਰਾਤਰੇ ਦਿਵਾਲੀ ਲੋਹੜੀ ਲੋਹੜੀ ਨੂੰ ਵੀ ਬਹੁਤ ਹੀ ਧੂਮਧਾਮ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਵੀ ਪੰਜਾਬ ਵਿੱਚ ਹੋਰ ਕਈ ਤਿਉਹਾਰ ਨੇ ਜਿਨ੍ਹਾਂ ਨੂੰ ਕਿ ਬਹੁਤ ਹੀ ਪਿਆਰ ਨਾਲ ਲੋਕ ਮਨਾਉਂਦੇ ਹਨ ਇਸ ਲਈ ਪੰਜਾਬ ਨੂੰ ਕਿਹਾ ਜਾਂਦਾ ਹੈ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ ਇਸ ਕਰਕੇ ਨਾ ਪੰਜਾਬ ਦੇ ਲੋਕ ਤਿਉਹਾਰਾਂ ਨੂੰ ਬੜੇ ਪਿਆਰ ਨਾਲ ਮਨਾਉਂਦੇ ਹਨ